ਮੈਨੂੰ ਰਨਿੰਗ ਕਰਨੇ ਦਾ ਸ਼ੌਕ ਹੈ ਅਤੇ ਮੈਂ ਦੇਖਿਆ ਕਿ ਜਦ ਮੈਂ ਰਨਿੰਗ ਕਰਨ ਜਾਂਦਾ ਤਾਂ ਲੋਕ ਘਰਦੇ ਕੱਪੜੇ ਹੀ ਪਾ ਕੇ ਰਨਿੰਗ ਕਰਨ ਲੱਗ ਜਾਂਦੇ ਹਨ ਮੈ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਮੈਂ ਆਪਣੇ ਰਨਿੰਗ ਵਾਸਤੇ ਇੱਕ ਨਾਇਕੀ ਦੇ ਸ਼ੂਜ਼ ਲਏ ਹੋਏ ਨੇ ਐਥਲੀਟ ਅਤੇ ਮੈਂ ਇੱਕ ਆਪਣੇ ਵਾਸਤੇ ਟਰੈਕਸੂਟ ਵੀ ਤਿਆਰ ਕਰਵਾਇਆ ਹੋਇਆ ਹੈ ਮੈਂ ਉਹਨਾਂ ਨੂੰ ਪਾ ਕੇ ਰਨਿੰਗ ਕਰਨ ਜਾਏ ਕਰਦਾ ਹਾਂ ਮੈਨੂੰ ਬੂ ਬੂਟ ਬਹੁਤ ਵਧੀਆ ਲੱਗਦੇ ਹਨ ਬੂਟ ਬਹੁਤ ਹੀ ਹਲਕੇ ਹਨ ਜੋ ਕਿ ਮੈਨੂੰ ਨੱਠਣ ਵਿੱਚ ਮੇਰੀ ਬਹੁਤ ਹੈਲਪ ਕਰਦੇ ਹਨ ਅਤੇ ਮੈਂ ਨੱਠਣ ਵਿੱਚ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਹੁੰਦਾ ਅਤੇ ਜਿਹੜਾ ਮੈਂ ਨਾਈਕੀ ਦਾ ਟਰੈਕਸੂਟ ਸਵਾਇਆ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਖੁੱਲ੍ਹਾ ਡੁੱਲਾ ਹੈ ਜੋ ਜੋ ਕਿ ਮੈ ਨੱਠਣ ਵਿੱਚ ਨੱਠਣ ਵਿੱਚ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਉਹਨਾਂ ਨੂੰ ਪਾ ਕੇ ਬਹੁਤ ਖੁਸ਼ੀ ਮਿਲਦੀ ਹੈ ਮੈਂ ਬਹੁਤ ਵਧੀਆ ਤਰੀਕੇ ਨਾਲ ਦੌੜਦਾ ਹਾਂ